ਹੈਲੋ ਸਤਿ ਸ਼੍ਰੀ ਅਕਾਲ ਕੀ ਤੁਸੀਂ ਸਵਿਗੀ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਮੇਰਾ ਨਾਮ ਜੈਸਮੀਨ ਕੌਰ ਮੈਂ ਪੰਦਰਾਂ ਮਿੰਟ ਪਹਿਲਾਂ ਦੋ ਹੋਟ ਕੌਫੀ ਦਾ ਔਡਰ ਦਿੱਤਾ ਸੀ ਅਤੇ ਔਡਰ ਨੰਬਰ ਫੋਰਟੀਨ ਹੈ ਅੱਧੇ ਘੰਟੇ 'ਚ ਤਾਂ ਔਡਰ ਰੇਡੀ ਹੋ ਜੂੰਗਾ ਪਰ ਮੇਰਾ ਇੱਥੋਂ ਘਰ ਤ ਦੂਰ ਹੈ ਕਾਫੀ ਅਤੇ ਮੈਂ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਔਡਰ ਹੈ ਦੋ ਹੋਟ ਕੋਫੀ ਦਾ ਇਹ ਇਹਦੀ ਪੈਕਜਿੰਗ ਇਹੋ ਜਿਹੀ ਹੋਵੇ ਕਿ ਇਹ ਮੇਰੇ ਘਰ ਆਉਂਦੇ ਤੱਕ ਹੀ ਹੋਟ ਹੀ ਰਹੇ ਠੰਡੀ ਨਾ ਹੋਵੇ ਅਤੇ ਇੱਕ ਹੋਰ ਇਹਦੀ ਪੈਕਜਿੰਗ ਇੱਦਾਂ ਦੀ ਹੋਵੇ ਕਿ ਇਹ ਡੁੱਲੇ ਨਾ ਮੇਰੇ ਘਰ ਤੱਕ ਆਉਂਦੇ 'ਤੇ ਐਟ ਦੈਨ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ